ਸਤਿ ਸ਼੍ਰੀ ਅਕਾਲ ਜੀ ਮੈਂ ਰਵੀਗੀਰੀ ਗੱਲ ਕਰ ਰਿਹਾ ਮੈਂ ਕੀ ਮੇਰੀ ਗੱਲ ਸੀ ਮੋਟਰ ਦੇ ਮੈਨੇਜਰ ਦਿਲਜੀਤ ਜੀ ਨਾਲ ਹੋ ਰਹੀ ਹੈ ਸਰ ਮੈਂ ਤੁਹਾਡਾ ਪੁਰਾਣਾ ਗ੍ਰਾਹਕ ਹਾਂ ਅਤੇ ਸਰ ਮੈਂ ਮਤ ਤੁਹਾਡੇ ਨਾਲ ਜਿਵੇਂ ਵੀ ਤੁਹਾਡੀਆਂ ਟੈਕਸੀਆਂ ਨੇ ਕੈਬ ਵਗੈਰਾ ਅਤੇ ਸਰ ਮੈਂ ਔਲਰੇਡੀ ਉਹਨਾਂ ਨੂੰ ਕਾਫੀ ਵਾਰ ਮਤਲਬ ਬੁੱਕਾ ਵਗੈਰਾ ਕਰਦਾ ਰਹਿੰਦਾ ਤੁਹਾਨੂੰ ਜਿਵੇਂ ਪਤਾ ਹੀ ਹੈ ਅਤੇ ਸਰ ਇਸ ਵਾਰ ਸਾਡਾ ਪਲੈਨ ਥੋੜ੍ਹਾ ਦੂਰ ਜਾਣ ਦਾ ਬਣਿਆ ਏ ਅਤੇ ਸਰ ਜਿਸ ਕਾਰਨ ਸਰ ਤੁਹਾਡੀ ਥੋੜ੍ਹੀ ਹੈਲਪ ਦੀ ਮੈਨੂੰ ਜ਼ਰੂਰਤ ਸੀਗੀ ਅਤੇ ਸਰ ਮੇਰੇ ਕੋਲ ਪਹਿਲਾਂ ਤੋਂ ਹੀ ਤੁਹਾਡੇ ਤਿੰਨ ਚਾਰ ਪ੍ਰੋਮੋ ਕੋਡ ਪਏ ਨੇ ਅਤੇ ਸਰ ਮੈਂ ਚੈੱਕ ਕੀਤਾ ਕਿ ਇਹਨਾਂ ਦੀ ਜਿਹੜੀ ਵੈਲਿਡੀਟੀ ਡੇਟ ਹੈ ਉਹ ਵੀ ਹਾਲੇ ਉਪਲਬਧ ਹੈ ਅਤੇ ਸਰ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਥੋੜ੍ਹਾ ਗਾਈਡ ਕਰੋ ਕਿ ਉਹ ਜਿਹੜੀ ਉਹਨਾਂ ਦੀ ਪ੍ਰੋਮੋ ਡੇਟ ਹੈ ਉਹ ਮੈਨੂੰ ਜਿਹੜਾ ਉਹਦਾ ਫਾਇਦਾ ਲੈਣ ਲਈ ਤੁਹਾਡੇ ਔਫਿਸ ਆਉਣਾ ਪਊਗਾ ਜਾਂ ਤੁਹਾਡੀ ਕੋਈ ਫ਼ੋਨ 'ਤੇ ਗੱਲ ਕ ਕਰਨੀ ਪਊਗੀ ਜਾਂ ਕੋਈ ਐਪ 'ਤੇ ਹੀ ਕੋਈ ਜੋ ਹੈ ਗੱਲਬਾਤ ਬਣਜੂਗੀ ਅਤੇ ਸਰ ਮੈਂ ਇੱਕ ਮੇਰੀ ਛੋਟੀ ਜੀ ਇੱਛਾ ਹੈ ਕਿ ਮੈਂ ਚਾਹੁੰਦਾ ਕਿ ਜਿਵੇਂ ਤੁਹਾਡਾ ਮੈਂ ਪੁਰਾਣਾ ਕਸਟਮਰ ਹੋਣ ਦੇ ਨਾਤੇ ਕਦੇ ਮੈਂ ਤੁਹਾਡੇ ਤੋਂ ਡਿਸਕਾਊਂਟ ਦੀ ਗੱਲ ਕੀਤੀ ਨਹੀਂ ਅਤੇ ਸਰ ਮੈਂ ਇਸ ਵਾਰ ਚਾਹੁੰਦਾ ਕਿ ਜੋ ਤੁਹਾਡਾ ਡਿਸਕਾਊਂਟ ਹੈ ਸਰ ਉਹ ਥੋੜ੍ਹਾ ਮੈਨੂੰ ਜ਼ਿਆਦਾ ਦਿੱਤਾ ਜਾਵੇ ਅਤੇ ਸਰ ਜਿੰਨੇ ਵੀ ਅਪ ਮੇਰੇ ਨਾਲ ਦੇ ਨੇ ਅਤੇ ਉਹ ਚਾਹੁੰਦੇ ਨੇ ਕਿ ਥੋੜ੍ਹਾ ਡਿਸਕਾਊਂਟ ਜ਼ਿਆਦਾ ਮਿਲਿਆ ਜਾਵੇ ਅਤੇ ਸਰ ਤੁਸੀਂ ਮੈਨੂੰ ਥੋੜ੍ਹਾ ਗਾਈਡ ਕਰੋ ਕਿ ਤਾਂ ਕਿ ਜੋ ਡਿਸਕਾਊਂਟ ਹੈ ਮੈਂ ਕਿਵੇਂ ਪ੍ਰਾਪਤ ਕਰਾਂ ਥੈਂਕ ਯੂ ਸਰ